ਸਤਿ ਸ਼੍ਰੀ ਅਕਾਲ ਸਰ ਹੋਰ ਕੀ ਹਾਲ ਚਾਲ ਹੈ ਆਸ ਹੈ ਕਿ ਤੁਸੀਂ ਠੀਕ ਹੋਵੋਗੇ ਜਿਵੇਂ ਕਿ ਮੇਰੀ ਕੱਲ੍ਹ ਤੁਹਾਡੇ ਨਾਲ ਗੱਲ ਹੋਈ ਸੀ ਮੈਂ ਨਵਾਂ ਸ਼ਹਿਰ ਤੋਂ ਦਿੱਲੀ ਜਾਣ ਲਈ ਤੁਹਾਡੀ ਕੈਬ ਬੁੱਕ ਕਰਾਈ ਹੋਈ ਹੈ ਅਤੇ ਉਸ ਕੈਬ ਦਾ ਕਿਰਾਇਆ ਮੈਂ ਤੁਹਾਡੇ ਨਾਲ ਪਹਿਲਾਂ ਹੀ ਡਿਸਕਸ ਕਰ ਲਿਆ ਸੀ ਕਿ ਮੈਂ ਕਿ ਤੁਸੀਂ ਮੈਨੂੰ ਦੱਸਿਆ ਹੋਇਆ ਸੀ ਕਿ ਨਵਾਂ ਸ਼ਹਿਰ ਤੋਂ ਦਿੱਲੀ ਜਾਣ ਲਈ ਅਤੇ ਜੋ ਵੀ ਮੈਂ ਉੱਥੇ ਘੁੰਮਣਾ ਫਿਰਨਾ ਹੈ ਚਾਰ ਦਿਨ ਲਈ ਮੈਂ ਉੱਥੇ ਜਾਣਾ ਹੈ ਅਤੇ ਚਾਰ ਦਿਨ ਲਈ ਜੋ ਵੀ ਉੱਥੇ ਘੁੰਮਣਾ ਫਿਰਨਾ ਹੋਵੇਗਾ ਉਸਦਾ ਕਿਰਾਇਆ ਤੁਸੀਂ ਪੰਦਰ੍ਹਾਂ ਹਜ਼ਾਰ ਰੁਪਏ 'ਤੇ ਮੁਕਾਇਆ ਹੋਇਆ ਸੀ ਇਹ ਗੱਲ ਮੇਰੀ ਤੁਹਾਡੇ ਨਾਲ ਕੱਲ੍ਹ ਹੀ ਹੋ ਚੁੱਕੀ ਸੀ ਜਿਵੇਂ ਕਿ ਅੱਜ ਮੈਂ ਨਵਾਂ ਸ਼ਹਿਰ ਤੋਂ ਦਿੱਲੀ ਆਈ ਹੋਈ ਹਾਂ ਤੁਹਾਡੀ ਹੀ ਕੈਬ ਰਾਹੀਂ ਆਈ ਹੋਈ ਹਾਂ ਜਿਸ ਟਾਈਮ ਮੈਂ ਦਿੱਲੀ ਪੁੱਜੀ ਤਾਂ ਮੇਰੀ ਡਰਾਈਵਰ ਨਾਲ ਵਾਰਤਾਲਾਪ ਹੋਈ ਅਤੇ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਸੀ ਵਾਰਤਾਲਾਪ ਦੌਰਾਨ ਕਿ ਮੈਂ ਜੋ ਕੈਬ ਦਾ ਕਿਰਾਇਆ ਹੈ ਉਹ ਮੈਂ ਉੱਥੇ ਜਾ ਕੇ ਉਸਨੂੰ ਕੈਸ਼ ਹੀ ਦੇ ਦੇਵਾਂਗੀ ਔਨਲਾਈਨ ਮੈਂ ਉਸਦੀ ਪੇਮੈਂਟ ਨਹੀਂ ਕਰਾਂਗੀ ਇਸ ਲਈ ਜਦੋਂ ਮੈਂ ਦਿੱਲੀ ਪਹੁੰਚੀ ਤਾਂ ਮੈਂ ਉਸਦਾ ਉਸਦੀ ਪੇਮੈਂਟ ਕਰਨ ਲਈ ਅਗਰ ਮੈਂ ਡਰਾਈਵਰ ਨੂੰ ਉਸਦਾ ਕਿਰਾਇਆ ਪੁੱਛਿਆ ਅਤੇ ਮੈਂ ਉਸਨੂੰ ਪੰਦਰ੍ਹਾਂ ਹਜ਼ਾਰ ਰੁਪਏ ਕੈਸ਼ ਦੇਣ ਲੱਗੀ ਉਸ ਨਾਲ ਮੈਂ ਗੱਲ ਮੁਕਾਈ ਕਿ ਮੈਂ ਏਜੰਸੀ ਨਾ ਟਰੈਵਲ ਏਜੰਸੀ ਨਾਲ ਗੱਲ ਕੀਤੀ ਹੋਈ ਹੈ ਕਿ ਮੈਂ ਇਸਦਾ ਕਿਰਾਇਆ ਜੋ ਹੈ ਪੰਦਰ੍ਹਾਂ ਹਜ਼ਾਰ ਹੀ ਦੇਵਾਂਗੀ ਤਾਂ ਉਸ ਟਾਈਮ ਦਰਾ ਡਰਾਈਵਰ ਨੇ ਕਿਹਾ ਕਿ ਨਹੀਂ ਇਸਦਾ ਕਿਰਾਇਆ ਪੰਦਰ੍ਹਾਂ ਹਜ਼ਾਰ ਨਹੀਂ ਇਸਦਾ ਕਿਰਾਇਆ ਦੋ ਹਜ਼ਾਰ ਰੁਪਇਆ ਤੁਹਾਨੂੰ ਹੋਰ ਐਕਸਟਰਾ ਦੇਣਾ ਪਵੇਗਾ ਜ਼ਿਆਦਾ ਦੇਣਾ ਪਵੇਗਾ ਮਤਲਬ ਕਿ ਮੈਨੂੰ ਪੰਦਰ੍ਹਾਂ ਹਜ਼ਾਰ ਨਹੀਂ ਸਤਾਰ੍ਹਾਂ ਹਜ਼ਾਰ ਰੁਪਏ ਦੇਣੇ ਪੈਣਗੇ ਪਰ ਜਿਵੇਂ ਕਿ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਪੰਦਰ੍ਹਾਂ ਹਜ਼ਾਰ ਰੁਪਏ 'ਤੇ ਅਤੇ ਮੈਂ ਸਿਰਫ ਪੰਦਰ੍ਹਾਂ ਹਜ਼ਾਰ ਰੁਪਏ ਦਾ ਹੀ ਭੁਗਤਾਨ ਕਰਾਂਗੀ ਮੈਂ ਇਸ ਤੋਂ ਜ਼ਿਆਦਾ ਇੱਕ ਵੀ ਰੁਪਏ ਦਾ ਭੁਗਤਾਨ ਨਹੀਂ ਕਰਾਂਗੀ ਅਗਰ ਡਰਾਈਵਰ ਪੈਸੇ ਨਹੀਂ ਲੈ ਰਿਹਾ ਤਾਂ ਮੈਂ ਇ ਇਹ ਪੈਸੇ ਪੰਦਰ੍ਹਾਂ ਹਜ਼ਾਰ ਰੁਪਏ ਤੁਹਾਨੂੰ ਕੱਲ੍ਹ ਆ ਕੇ ਖੁਦ ਆਪਣੇ ਹੱਥੀਂ ਕੈਸ਼ ਫੜਾ ਦੇਵਾਂਗੀ ਜਦੋਂ ਵੀ ਮੈਂ ਆਪਣੇ ਦਿੱਲੀ ਤੋਂ ਵਾਪਸੀ ਹੋਵੇਗੀ ਪਰ ਜਿਸ ਜਿਸ ਕਿਰਾਏ ਦੀ ਮੇਰੇ ਨਾਲ ਗੱਲ ਹੋਈ ਹੈ ਮੈਂ ਉਹੀ ਕਿਰਾਏ ਦਾ ਭੁਗਤਾਨ ਕਰਾਂਗੀ ਮੈਂ ਇਸ ਤੋਂ ਜ਼ਿਆਦਾ ਕਿਰਾਏ ਦਾ ਭੁਗਤਾਨ ਨਹੀਂ ਕਰਾਂਗੀ ਇਸ ਲਈ ਮੈਂ ਜੋ ਵੀ ਭੁਗਤਾਨ ਹੈ ਉਹ ਤੁਹਾਨੂੰ ਖੁਦ ਆ ਕੇ ਤੁਹਾਡੇ ਟਰਾਂਸਪੋਰਟ ਏਜੰਸੀ 'ਤੇ ਆ ਕੇ ਤੁਹਾਨੂੰ ਖੁਦ ਹੀ ਫੜਾ ਦੇਵਾਂਗੀ ਧੰਨਵਾਦ